ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਸਾਜ਼ ਬਹੁਤ ਹੀ ਜ਼ਿਆਦਾ ਵਰਾਇਟੀ ਦੇ ਵਿੱਚ ਸਾਨੂੰ ਮਿਲ ਜਾਂਦੇ ਹਨ ਜੇਕਰ ਅਸੀਂ ਦੇਖੀਏ ਤਾਂ ਭਾਰਤੀ ਸਾਜ਼ ਹਨ ਕੁਝ ਅਤੇ ਕੁਝ ਕੁ ਵਿਦੇਸ਼ੀ ਸਾਜ਼ ਹਨ ਜੇਕਰ ਭਾਰਤੀ ਸਾਜ਼ਾਂ ਦੀ ਵੰਡ ਕੀਤੀ ਜਾਵੇ ਤਾਂ ਕੁਝ ਭਾਰਤੀ ਸਾਜ਼ ਇਹੋ ਜਿਹੇ ਹਨ ਜਿਨ੍ਹਾਂ ਦੇ ਵਿੱਚ ਸੁਰ ਹੁੰਦਾ ਹੈ ਅਤੇ ਕੁਝ ਇਹੋ ਜਿਹੇ ਹਨ ਜਿਨ੍ਹਾਂ ਦੇ ਵਿੱਚ ਰੀਦਮ ਨੂੰ ਬਣਾਇਆ ਜਾਂਦਾ ਹੈ ਸੋ ਅਕਸਰ ਜਦੋਂ ਵੀ ਮੇਰਾ ਦਿਲ ਕਰਦਾ ਹੈ ਤਾਂ ਮੈਂ ਆਪਣੇ ਭਰਾ ਨੂੰ ਕਹਿੰਦੀ ਹਾਂ ਕਿ ਉਹ ਤਬਲਾ ਵਜਾ ਦਿੰਦਾ ਹੈ ਅਤੇ ਮੈਂ ਹਰਮੋਨੀਅਮ ਵਜਾ ਲੈਂਦੀ ਹਾਂ ਜੋ ਕਿ ਮੈਨੂੰ ਵਜਾਉਣਾ ਬਹੁਤ ਹੀ ਜ਼ਿਆਦਾ ਸਕੂਨ ਦੇਣ ਵਾਲਾ ਲੱਗਦਾ ਹੈ ਅਤੇ ਜਿੱਦਾਂ ਕਿ ਕਈ ਵਾਰ ਜੇ ਕੋਈ ਨਾਲ ਹੁੰਦਾ ਹੈ ਤਾਂ ਅਸੀਂ ਨਾਲ ਉਹਨਾਂ ਨੂੰ ਬਿਠਾ ਕੇ ਛੈਣੇ ਵੀ ਵਜਾ ਲੈਂਦੇ ਹਨ ਇਸ ਤਰ੍ਹਾਂ ਅਸੀਂ ਬਹੁਤ ਹੀ ਇੱਕ ਧਾਰਮਿਕ ਮਾਹੌਲ ਬਣਾ ਕੇ ਰੱਬ ਦੀ ਭਜਨ ਬੰਦਗੀ ਵੀ ਕਰ ਲੈਂਦੇ ਹਾਂ ਜਦੋਂ ਹੀ ਅਸੀਂ ਸਾਰੇ ਇਹਨਾਂ ਤਿੰਨ ਸਾਜ਼ਾਂ ਦਾ ਸੁਮੇਲ ਕਰਦੇ ਹਾਂ ਹਰਮੋਨੀਅਮ ਛੈਣੇ ਅਤੇ ਤਬਲਾ ਤਾਂ ਇੱਕ ਬਹੁਤ ਹੀ ਸਕੂਨ ਵਾਲਾ ਮਾਹੌਲ ਬਣ ਜਾਂਦਾ ਹੈ ਅਤੇ ਸੰਗੀਤ ਵੀ ਬਹੁਤ ਹੀ ਜ਼ਿਆਦਾ ਪਿਆਰਾ ਲੱਗਣ ਲੱਗ ਪੈਂਦਾ ਹੈ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਐਨੇ ਸਾਰੇ ਸਾਜ਼ਾਂ ਦੇ ਵਿੱਚ ਜੋ ਕਿ ਤਬਲਾ ਛੈਣੇ ਗਿਟਾਰ ਸਿਤਾਰ ਸਾਰੰਗੀ ਤੁੰਗੀ ਜੋ ਵੀ ਹਨ ਇਹ ਸਾਰੇ ਹੀ ਬਹੁਤ ਜ਼ਿਆਦਾ ਚੰਗੀਆਂ ਇੱਕ ਸੁਰਾਂ ਦਿੰਦੇ ਹਨ ਅਤੇ ਸਾਜ਼ ਦੇ ਨਾਲ ਜੋ ਇੱਕ ਰਿਦਮ ਹੈ ਬਹੁਤ ਹੀ ਪਿਆਰੀ ਪੈਦਾ ਹੋ ਜਾਂਦੀ ਹੈ ਤਾਂ ਕਰਕੇ ਮੈਂ ਇਹਨਾਂ ਸਾਜ਼ਾਂ ਦੇ ਨਾਲ ਗਾਉਣਾ ਪਸੰਦ ਕਰਦੀ ਹਾਂ